ਚੈਟ ਜੀ ਪੀ ਟੀ ਇੱਕ ਏ ਆਈ ਭਾਸ਼ਾ ਦਾ ਮਾਡਲ ਹੈ ਜਿਸ ਦੇ ਬਾਰੇ ਮੇਰੇ ਇਹ ਵਿਚਾਰ ਹਨ ਕਿ ਇਹ ਬੁਹਤ ਹੀ ਚੰਗਾ ਏ ਆਈ ਮਾਡਲ ਤਿਆਰ ਕੀਤਾ ਗਿਆ ਹੈ ਇਹ ਮੋਡਲ ਬਹੁਤ ਹੀ ਲਾਭਦਾਇਕ ਹੁੰਦਾ ਹੈ ਜਵਾਕਾਂ ਵਾਸਤੇ ਜਿਹੜੇ ਜਵਾਕ ਪੜ੍ਹਾਈ ਕਰਦੇ ਹਨ ਉਹਨਾਂ ਵਾਸਤੇ ਤਾਂ ਇਹ ਮੋਡਲ ਬਹੁਤ ਹੀ ਚੰਗਾ ਹੈ ਜਵਾਕ ਆਪਣੀ ਪੜ੍ਹਾਈ ਦੇ ਵਿੱਚ ਇਸ ਮੋਡਲ ਦੇ ਨਾਲ ਆਪਣੇ ਸਵਾਲਾਂ ਦੇ ਉੱਤਰ ਵੇਖ ਸਕਦੇ ਹਨ ਨਾਲੇ ਹੋਰ ਵੀ ਨੌਲੇਜ ਲੈ ਸਕਦੇ ਹਨ ਇਹ ਮੋਡਲ ਹੁਨ ਕੁਛ ਹੀ ਟਾਈਮ ਪਹਿਲਾਂ ਆਇਆ ਸੀ ਇਸ ਮੋਡਲ ਦੇ ਨਾਲ ਤੁਹਾਡੀ ਨੌਲੇਜ ਬਹੁਤ ਜ਼ਿਆਦਾ ਵਧਦੀ ਹੈ ਨਾਲੇ ਇਹ ਮੋਡਲ ਬਹੁਤ ਜ਼ਿਆਦਾ ਮਦਦਗਾਰ ਹੋਇਆ ਹੈ ਜਿੰਨੇ ਵੀ ਲੋਕ ਭਾਵੇਂ ਅਨਪੜ੍ਹ ਭਾਵੇਂ ਪੜ੍ਹੇ ਲਿਖੇ ਹਨ ਉਹ ਸਾਰੇ ਇਸ ਮੋਡਲ ਦੀ ਵਰਤੋਂ ਕਰ ਸਕਦੇ ਹਨ ਆਪਾਂ ਨੂੰ ਇਸ ਮੋਡਲ ਵਿੱਚ ਹੋਰ ਕੁਝ ਨਹੀਂ ਬਸ ਲਿਖਣਾ ਹੁੰਦਾ ਹੈ ਜੋ ਵੀ ਆਪਣਾ ਸਵਾਲ ਹੈ ਅਤੇ ਆਪਾਂ ਨੂੰ ਇੱਕ ਬਹੁਤ ਹੀ ਚੱਜ ਦੇ ਨਾਲ ਇੱਕ ਸ ਕੀ ਕਹਿੰਦੇ ਨੇ ਉੱਤਰ ਪ੍ਰਸਤੁਤ ਕੀਤਾ ਜਾਂਦਾ ਹੈ ਉਹ ਉੱਤਰ ਜੇ ਤੁਸੀਂ ਆਰਾਮ ਨਾਲ ਪੜ੍ਹੋ ਤਾਂ ਤੁਹਾਨੂੰ ਉਸ ਦੇ ਨਾਲ ਕੋਈ ਕਨਫਿਊਜ਼ਨ ਵੀ ਨਹੀਂ ਹੁੰਦੀ ਜੇ ਆਪਾਂ ਗੂਗਲ ਵਿੱਚ ਉਹੀਓ ਪ੍ਰਸ਼ਨ ਪਾਈਏ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਉੱਤਰ ਮਿਲ ਜਾਂਦੇ ਹਨ ਜਿਹਦੇ ਕਰਕੇ ਇੱਕ ਸਮੇਂ ਤੋਂ ਬਾਅਦ ਆਪਾਂ ਆਪ ਹੀ ਉਲਝ ਜਾਂਦੇ ਹਾਂ ਪ੍ਰੰਤੂ ਚੈਟ ਜੀ ਪੀ ਟੀ ਤੋਂ ਇੱਕੋਂ ਉੱਤਰ ਮਿਲਦਾ ਹੈ ਜਿਹਦੇ ਕਰਕੇ ਉਲਝਨ ਘੱਟ ਹੁੰਦੀ ਹੈ ਨਾਲੇ ਉਹ ਉੱਤਰ ਵੀ ਸਹੀ ਅਤੇ ਸੰਪ ਸ ਅਤੇ ਸੰਪੂਰਨ ਹੁੰਦਾ ਹੈ ਇਸ ਤੋਂ ਸਭ ਇਸ ਦੀ ਸਭ ਤੋਂ ਜ਼ਿਆਦਾ ਮਦਦਗਾਰ ਚੀਜ਼ ਇਹ ਹੀ ਹੈ ਕਿ ਇਹ ਏ ਆਈ ਮੋਡਲ ਉਲਝਨਾ ਵਿੱਚ ਨਹੀਂ ਪਾਉਂਦਾ ਪ੍ਰੰਤੂ ਇੱਕ ਸਪੱਸ਼ਟ ਉੱਤਰ ਦੇ ਦਿੰਦਾ ਹੈ